ਆਮ ਤੌਰ 'ਤੇ ਅਸੀਂ ਦੁਪਹਿਰੇ ਚੌਲ ਅਤੇ ਦਾਲ ਰੋਟੀ ਖਾਣਾ ਪਸੰਦ ਕਰਦੇ ਹਾਂ ਅਤੇ ਰਾਤ ਨੂੰ ਸਬਜ਼ੀ ਅਤੇ ਰੋਟੀ ਖਾਣਾ ਪਸੰਦ ਕਰਦੇ ਹਾਂ